ਬਾਗਬਾਨੀ ਕਰਦੇ ਸਮੇਂ ਵੈਸੇ ਤਾਂ ਮੈਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈਗਾ ਏ ਉਹਨਾਂ ਵਿੱਚੋਂ ਜਿਹੜੀਆਂ ਮੁੱਖ ਚੁਣੌਤੀਆਂ ਹੈਗੀਆਂ ਸਭ ਤੋਂ ਪਹਿਲਾਂ ਹੁੰਦਾ ਹੈਗਾ ਇੱਕ ਤਾਂ ਵਧੀਆ ਕੁਆਲਿਟੀ ਦਾ ਬੀਜ ਕਿਉਂਕਿ ਜੇ ਅਗਰ ਬਾਗਬਾਨੀ ਤਾਂ ਹੀ ਤੁਹਾਡੀ ਵਧੀਆ ਪ੍ਰਫੁੱਲਿਤ ਹੋ ਸਕਦੀ ਹੈਗੀ ਹੈ ਅਗਰ ਜੇ ਆਪਾਂ ਵਧੀਆ ਕਿਸਮ ਦਾ ਬੀਜ ਅਤੇ ਵਧੀਆ ਉਹਦੇ ਕੁਆਲਿਟੀ ਦਾ ਬੀਜ ਪਾਊਂਗੇ ਹੈਗੇ ਆ ਤਾਂ ਹੀ ਸਾਨੂੰ ਕਿਉਂਕਿ ਅੱਜ ਕੱਲ੍ਹ ਜੇ ਆਪਾਂ ਬਾਗਬਾਨੀ ਦੇਖੀ ਵੀ ਜਾਵੇ ਤਾਂ ਬਾਗਬਾਨੀ ਆਪਾਂ ਤਾਂ ਜ਼ਿਆਦਾਤਰ ਆਪਾਂ ਬਾਗਬਾਨੀ ਪੈਸਿਆਂ ਦੇ ਅਕੋਡਿੰਗ ਹੀ ਕਰਦੇ ਹੈ ਕਿਉਂਕਿ ਆਪਾਂ ਜੇ ਬਾਗਬਾਨੀ ਕੀਤੀ ਜਾਵੇ ਤਾਂ ਹਰ ਇੱਕ ਬੰਦਾ ਕੋਈ ਵੀ ਕੰਮ ਕਰਦਾ ਉਹਦੇ ਵਿੱਚ ਆਪਣਾ ਪ੍ਰੋਫਿਟ ਦੇਖਦਾ ਹੈ ਪੈਸਾ ਦੇਖਦਾ ਏ ਮੈਨੂੰ ਇਹਦੇ ਵਿੱਚੋਂ ਕਿੰਨਾ ਪ੍ਰੋਫਿਟ ਆਊਂਗਾ ਤਾਂ ਇਹਦੇ ਵਿੱਚ ਜਿਹੜੀਆਂ ਮੈਨੂੰ ਚੁਣੌਤੀਆਂ ਆਈਆਂ ਇਨ੍ਹਾਂ ਵਿੱਚ ਸਭ ਤੋਂ ਸਭ ਤੋਂ ਜਿਹੜੀ ਮੇਨ ਚਨੌਤੀ ਹੈ ਇੱਕ ਬੀਜ ਦੀ ਅਤੇ ਦੂਜੀ ਖਾਦ ਦੀ ਜਿਹੜੀ ਬੀਜ ਦੀ ਸੀਗੀ ਚੁਣੌਤੀ ਉਹ ਤਾਂ ਮੈਂ ਮਤਲਬ ਆਪਣੇ ਦੋਸਤਾਂ ਤੋਂ ਕਈਆਂ ਨੂੰ ਸਲਾਹ ਲਈ ਹੈਗੀ ਹੈ ਵੀ ਇਹਨਾਂ ਨੂੰ ਬੀਜ ਮਤਲਬ ਕਿਹੜੀ ਕੁਆਲਟੀ ਦਾ ਵਧੀਆ ਮੈਨੂੰ ਦੋਸਤਾਂ ਨੇ ਚੰਗਾ ਚੰਗਾ ਉਹਦੇ ਬਾਰੇ ਦੱਸਿਆ ਗਾਈਡ ਕੀਤਾ ਉਹਨਾਂ ਨੇ ਤਾਂ ਮੈਂ ਆਪਣੀ ਜਿਹੜੀ ਬੀਜ ਦੀ ਚੁਨੌਤੀਆਂ ਸੀਗੀਆਂ ਉਹ ਮੈਂ ਹੱਲ ਕਰ ਲਈਆਂ ਉਹ ਤੋਂ ਬਾਅਦ ਰਹੀ ਗੱਲ ਦੂਜੀ ਖਾਦ ਦੀ ਤਾਂ ਮੇਰੇ ਜਿਹੜਾ ਦੂਜੇ ਦੋਸਤ ਨੇ ਦੱਸਿਆ ਉਹ ਤੋਂ ਬਾਅਦ ਅਗਰ ਤੁਸੀਂ ਬਾਗਬਾਨੀ ਅਗਰ ਵਧੀਆ ਕਰਨੀ ਹੈਗੀ ਹੈ ਅਗਰ ਤੁਸੀਂ ਲੰਬੇ ਟਾਈਮ ਵਾਸਤੇ ਇਹਨੂੰ ਕਰਨਾ ਚਾਹੁੰਦੇ ਹੈਗੇ ਆ ਤਾਂ ਤਾਂ ਤੁਸੀਂ ਮਤਲਬ ਜਿਹੜੀ ਇਹਦੇ ਵਾਸਤੇ ਜਿਹੜੀ ਔਰਗੈਨਿਕ ਖਾਦ ਹੈ ਫਰਟੀਲਾਈਜ਼ਰ ਹੈ ਉਹ ਫਰਟੀਲਾਈਜ਼ਰ ਛੱਡ ਕੇ ਔਰਗੈਨਿਕ ਖਾਦ ਨੂੰ ਪਾਓ ਇਹਦੇ ਨਾਲ਼ ਜਿਹੜੇ ਤੁਹਾਡੇ ਹੈਗੇ ਆ ਕੈਮੀਕਲ ਤੋਂ ਵੀ ਮਤਲਬ ਤੁਹਾਡਾ ਬਚਾ ਹੋਊਂਗਾ ਤੁਹਾਡੀ ਬਾਗਬਾਨੀ ਜਿਹੜੇ ਬੂਟੇ ਹੈਗੇ ਆ ਉਹ ਵੀ ਤੁਹਾਡੇ ਵਧੀਆ ਵਧੂਂਗੇ ਫੁੱਲੂਂਗੇ